ਹਾਂਜੀ ਕੌਣ ਜੀ ਹਾਂਜੀ ਸਰ ਐਕਚੁਲੀ ਕੰਪਿਊਟਰ ਟੈਕਨੀਸ਼ਅਨ ਗੱਲ ਕਰ ਰਹੇ ਹੋ ਹਾਂਜੀ ਸਰ ਸਰ ਜੀ ਮੈਂ ਕੰਪਿਊਟਰ ਮੈਨੂੰ ਲਿਤੇ ਹੋਏ ਦਸ ਸਾਲ ਹੋ ਗਏ ਨੇ ਲੇਕਿਨ ਹੁਣ ਮੈਂ ਥੋੜ੍ਹਾ ਪਿਛਲੇ ਵਰਜ਼ਨ 'ਚ ਨਾ ਹੁਣ ਉਹਨੂੰ ਅਪਡੇਟ ਕਰਵਾਇਆ ਸੀ ਵਿੰਡੋਜ਼ ਨੂੰ ਹੁਣ ਮੈਂ ਜਦੋਂ ਉੱਥੇ ਜਿਹੜਾ ਡਾਕੂਮੈਂਟ 'ਤੇ ਕੰਮ ਕਰਦੀ ਹਾਂ ਐੱਮ ਐੱਸ ਡਾਕੂਮੈਂਟ 'ਤੇ ਉਹ ਮੇਰਾ ਓਪਨ ਹੀ ਨਹੀਂ ਹੋ ਰਿਹਾ ਅਤੇ ਇੱਕ ਵਾਰੀ ਮੈਂ ਕਿਸੇ ਦੇ ਕੋਲੋਂ ਓਪਨ ਕਰਵਾਇਆ ਅਤੇ ਉਹ ਹੁਣ ਸੇਵ ਨਹੀਂ ਹੋ ਰਿਹਾ ਅਤੇ ਹੁਣ ਸਰ ਇਹਦਾ ਮੈਂ ਕੀ ਇਲਾਜ ਕਰਾਂ ਕਿਉਂਕਿ ਮੇਰਾ ਤਾਂ ਮੈਂ ਪੇਪਰ ਬਣਾਉਣੇ ਨੇ ਬਿੰਗ ਟੀਚਰ ਮੈਂ ਕੀ ਕਰਾਂ

ਹਾਂਜੀ ਹਾਂਜੀ ਹਾਂਜੀ ਨਹੀਂ ਸਰ ਇੱਦਾਂ ਤਾਂ ਮੈਨੂੰ ਸਮਝ ਨਹੀਂ ਹੈਗੀ ਹੋ ਸਕਦਾ ਮੈਂ ਨਾ ਕਰਵਾਇਆ ਹੋਵੇ ਅੱਛਾ ਜੀ ਠੀਕ ਹੈ ਜੀ ਠੀਕ ਹੈ ਸਰ ਠੀਕ ਹੈ ਠੀਕ ਹੈ ਸਰ ਠੀਕ ਆ ਸਰ ਅੱਛਾ ਸਰ ਇਹਦੇ ਨਾਲ ਮੈਨੂੰ ਇੱਕ ਪ੍ਰੋਬਲਮ ਹੋਰ ਵੀ ਆ ਰਹੀ ਹੈ ਅਤੇ ਉੱਥੇ ਜਦੋਂ ਮੈਂ ਸਕਰੀਨ ਸੇਵਰ ਲਗਾਉਂਦੀ ਹਾਂ ਆਪਣੇ ਕੰਪਿਊਟਰ 'ਤੇ ਅਤੇ ਉਹ ਦੋ ਦਿਨ ਦੇ ਬਾਅਦ ਔਟੋਮੈਟਿਕਲੀ ਫਿਰ ਉਹ ਬਲੈਂਕ ਉਹਨੂੰ ਜਿਵੇਂ ਅਸੀਂ ਕਹਿੰਦੇ ਹਾਂ ਕਿ ਔਨ ਕੀਤਾ ਅਤੇ ਉਸੇ ਵਾਲਾ ਸ਼ੋ ਹੋਣ ਲੱਗ ਪਿਆ ਜਿਹੜੀ ਫੋਟੋਗ੍ਰਾਫ਼ ਮੈਂ ਉੱਥੇ ਲਗਾਉਂਦੀ ਹਾਂ ਜਾਂ ਸੀਨਰੀ ਕਹਿ ਲਉ ਉਹ ਵੀ ਦੋ ਦਿਨ ਦੇ ਬਾਅਦ ਉੱਥੋਂ ਦੀ ਗਾਇਬ ਹੁੰਦੀ ਹੈ ਉਹਦਾ ਕੀ ਰੀਜ਼ਨ ਆ

ਓਕੇ ਓਕੇ ਓਕੇ ਮਤਲਬ ਇਹ ਜਿਹੜੇ ਸਕਰੀਨ ਸੇਵਰ ਹੁੰਦੇ ਨੇ ਇਹ ਐਂਵੇ ਮਤਲਬ ਟਾਈਮ ਡਿਊਰੇਸ਼ਨ ਦੇ ਨਾਲ ਉਹਨਾਂ ਦਾ ਹੁੰਦਾ ਵਾ ਅੱਛਾ ਇਹਦਾ ਮਤਲਬ ਕਿ ਸਾਰਾ ਅਪਡੇਟ ਹੋਣ ਵਾਲਾ ਇੱਕ ਮਿੰਟ 'ਚ ਹੀ ਫਿਰ ਤੋਂ ਹੋਏਗਾ ਔਟੋ ਰਨ ਜਿਵੇਂ ਉੱਥੇ ਅਸੀਂ ਉਹਨੂੰ ਕਹਿੰਦੇ ਹਾਂ ਠੀਕ ਹੈ ਉਹਦੇ ਨਾਲ ਹੋਇਆ ਕਿ ਮੇਰੇ ਸਾਰੀਆਂ ਵਿੰਡੋਜ਼ ਵਗੈਰਾ ਵੀ ਅਪਡੇਟ ਹੋ ਜਾਣਗੀਆਂ ਓਕੇ ਸਰ ਜੀ ਓਕੇ ਸਰ ਜੀ ਥੈਂਕ ਯੂ ਜੀ ਥੈਂਕ ਯੂ ਜੀ ਓਕੇ ਥੈਂਕ